ਬੀ ਆਰ ਐਸ ਨਗਰ ਮੋਡਲ ਟਾਊਨ ਆਤਮ ਨਗਰ ਗਿਲ ਰੋਡ ਵਿਸ਼ਕਰਮਾ ਚੌਂਕ ਢੋਲੇਵਾਲ ਸ਼ੇਰਪੁਰ ਚੌਂਕ ਕਿਪਸ ਮਾਰਕੀਟ ਫੀਲਡ ਗੰਜ ਭਾਰਤ ਨਗਰ ਚੌਂਕ ਪਵੀਲੀਅਨ ਮਾਲ ਏਰੀਆ ਹੈਬੋਵਾਲ